ਜਿੱਥੋਂ ਤੱਕ ਪਰਿਵਾਰ ਦੀ ਗੱਲ ਕਰੀਏ ਮੈਂ ਆਪਣੇ ਪਰਿਵਾਰ ਬਾਰੇ ਦੱਸਦੀ ਹਾਂ ਕਿ ਸਾਡਾ ਪਰਿਵਾਰ ਪ ਛੋਟਾ ਜਿਹਾ ਪਰਿਵਾਰ ਆ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਛੋਟਾ ਪਰਿਵਾਰ ਅਤੇ ਸੁਖੀ ਪਰਿਵਾਰ ਸਾਡੇ ਮਤਲਬ ਕਿ ਮੇਰੇ ਹਸਬੈਂਡ ਦੋਨੋਂ ਬ੍ਰਦਰ ਹੀ ਹੈ ਇੱਕ ਤਾਂ ਬਾਹਰ ਸੈਟਲ ਹੈ ਬਾਰਮੀ ਸਕਿਓਟ ਔਫ ਸਟੇਸ਼ਨ ਹੈ ਅਤੇ ਅਸੀਂ ਇੱਥੇ ਹਾਂ ਅਤੇ ਬਸ ਮਦਰ ਇਨ ਲਾਅ ਹੈ ਸਾਡੇ ਨਾਲ ਬੇਟਾ ਹੈ ਮੇਰਾ ਛੋਟਾ ਬੇਟੀ ਕੈਨੇਡਾ ਹੈ ਹੁਣ ਤਾਂ ਅਸੀਂ ਹੋਰ ਵੀ ਛੋਟਾ ਛੋਟਾ ਜਿਹਾ ਪਰਿਵਾਰ ਹੋ ਗਿਆ ਅਤੇ ਕਿ ਗਵਰਮੈਂਟ ਜੋਬ ਹੈ ਮੇਰੇ ਹਸਬੈਂਡ ਦੀ ਜਿਹਦੇ ਵਿੱਚ ਸਾਨੂੰ ਅੱਛੀ ਇਨਕਮ ਹੋਣ ਕਰਕੇ ਬਹੁਤ ਅੱਛਾ ਚੱਲ ਰਿਹਾ ਸਾਡੇ ਪਰਿਵਾਰ ਦਾ ਜਿੱਥੇ ਤੱਕ ਆਪਣੇ ਦੋਸਤਾਂ ਦੀ ਗੱਲ ਕਰਿਆ ਦੋਸਤ ਵੀ ਮੇਰੇ ਬਹੁਤ ਅੱਛੇ ਮੈਂ ਬਹੁਤ ਜ਼ਿਆਦਾ ਦੋਸਤ ਨਹੀਂ ਬਣਾਏ ਹੋਏ ਮਤਲਬ ਕਿ ਜਿੰਨੇ ਵੀ ਬਣਾਏ ਆ ਅੱਛੇ ਬਣਾਏ ਅੱਛੇ ਘਰ ਦੇ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਕਿ ਕਰੈਕਟਰ ਦੇ ਠੀਕ ਨਾ ਹੋਣ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੇ ਜਿੰਨੇ ਵੀ ਫਰੈਂਡਸ ਆ ਬੜੇ ਅੱਛੇ ਅਸੀਂ ਇਕੱਠੇ ਘੁੰਮਣ ਫਿਰਨ ਵੀ ਜਾਂਦੇ ਹਾਂ ਕਿਤੇ ਵੀ ਜਾਣਾ ਸਾਡੇ 'ਚ ਅੱਜ ਤੱਕ ਕਦੀ ਕਿਸੇ ਤਕਾ ਤਰ੍ਹਾਂ ਦੀ ਲੜਾਈ ਝਗੜਾ ਨਹੀਂ ਹੋਇਆ ਅਸੀਂ ਜਿਸ ਤਰ੍ਹਾਂ ਕਈ ਫਰੈਂਡਸ ਦੇ ਵਿੱਚ ਪੈਸੇ ਨੂੰ ਲੈ ਕੇ ਹੋ ਜਾਂਦਾ ਕਿ ਅਸੀਂ ਘੁੰਮਣ ਜਾਣਾ ਇਸ ਤਰ੍ਹਾਂ ਖਰਚਾ ਔਰ ਅਸੀਂ ਜੋ ਵੀ ਗੱਲ ਖੁੱਲ੍ਹ ਕੇ ਕਲੀਅਰ ਕਰ ਕਰਕੇ ਚੱਲਣਾ ਹਾਂਜੀ ਅਸੀਂ ਉੱਥੇ ਚੱਲੇ ਹਾਂ ਅ ਆਪਣਾ ਆਪਣਾ ਖਰਚਾ ਆਪੇ ਸਾਰਿਆਂ ਨੇ ਕਰਨਾ ਵਾ ਜੋ ਵੀ ਖਾਣਾ ਹੈ ਆਪਣਾ ਆਪਣਾ ਲੈ ਕੇ ਖਾਣਾ ਵਾ ਜਾਣਾ ਅਸੀਂ ਇਕੱਠਿਆਂ ਵਾ ਘੁੰਮਣ ਫਿਰਨ ਜਾਣਾ ਅਤੇ ਇਸ ਤਰ੍ਹਾਂ ਮੈਂ ਮੈਂ ਮੈਨੂੰ ਬਹੁਤ ਹੀ ਅੱਛੀ ਤਰ੍ਹਾਂ ਖੁਸ਼ ਹਾਂ ਕਿ ਮੇਰੇ ਫਰੈਂਡਸ ਜਿੰਨੇ ਵੀ ਆ ਅਸੀਂ ਇਸ ਤਰ੍ਹਾਂ ਇੰਜੋਏ ਬਹੁਤ ਕਰਦੇ ਹਾਂ ਕਿਸੇ ਨੂੰ ਕਿਸੇ ਹੋਰ ਦੀ ਲੋੜ ਨਹੀਂ ਪੈਂਦੀ ਫਰੈਂਡਸ ਘੁੰਮਣ ਆਪਾਂ ਚਲ ਜਾਂਦੇ ਹਾਂ